ਗਤਕੇ ਵਿੱਚ ਦੋ ਪੱਖਾਂ ਵਿੱਚ ਨਿਪੁੰਤਕਾਂ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਦਾ ਹਮਲਾ ਰੋਕਣਾ ਅਤੇ ਦੂਜੇ ਵਿਰੋਧੀ 'ਤੇ ਹਮਲਾ ਕਰਨਾ ਗਤਕਾ ਖੇਡਣੀ ਮੁੱਖ ਤਰ੍ਹਾਂ ਦੇ ਦੋ ਹਥਿਆਰ ਵਰਤੇ ਜਾਂਦੇ ਹਨ ਜਿਸ ਵਿੱਚ ਇੱਕ ਹੈ ਸੋਟੀ ਅਤੇ ਦੂਸਰਾ ਹੈ ਤਲਵਾਰ ਗਤਕਾ ਇੱਕ ਮੀਟਰ ਦੇ ਕਰੀਬ ਡੰ ਲੰਬਾ ਡੰਡਾ ਹੁੰਦਾ ਹੈ ਅਤੇ ਇੱਕ ਦੇ ਸਿਰੇ 'ਤੇ ਹੱਥ ਦੀ ਚੰਗੀ ਪਕੜ ਸੁਰੱਖਿਆ ਗੱਦੀ ਲਗਾਈ ਜਾਂਦੀ ਹੈ ਢਾਲ ਲੱਕੜ ਜਾਂ ਲੋਹੇ ਦੀ ਬਣੀ ਹੁੰਦੀ ਜਿਸ ਦੇ ਅੰਦਰਲੇ ਪਾਸੇ ਫੜਨ ਲਈ ਮਜ਼ਬੂਤ ਕੁੰਡੀ ਲਗਾਈ ਹੁੰਦੀ ਹੈ ਗਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੁਛ ਮਹਾ ਮੁਹਾਰਤ ਹਾਸਲ ਕਰਨ ਲੈਣ ਤੋਂ ਬਾਅਦ ਤਲਵਾਰ ਅਤੇ ਪ੍ਰਮੁੱਖ ਹੱਥਿਆਰਾਂ ਜਿਵੇਂ ਕਿ ਚੱਕਰ ਨੇ ਜਾਂ ਸਾਰਿਆਂ ਦੀ ਤਬਰ ਸਾਰਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਗਤਕਾ ਨਿਹੰਗ ਸਿੰਘਾਂ ਦੀ ਖਾਸ ਕਰਕੇ ਖੇਡਾਂ 'ਚ ਇੱਕ ਬਹੁਤ ਪ੍ਰਚਲਿਤ ਖੇਡ ਹੈ